ਮੈਂ ਆਪਣੇ ਪਿੰਡ ਦਾ ਤੁਹਾਡੇ ਨਾਲ ਇੱਕ ਵਾਕਿਆ ਸਾਂਝੀ ਕਰ ਰਿਹਾ ਹੈ ਜਿਸ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਧਾਰਮਿਕ ਸਮੂਹ ਤੋਂ ਕੋਈ ਵਿੱਤੀ ਸਹਾਇਤਾ ਬਾਰੇ ਇੱਕ ਵਾਰ ਦੀ ਗੱਲ ਹੈ ਕਿ ਸਾਡੇ ਪਿੰਡ ਵਿੱਚ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਆ ਉਹ ਉਹਨਾਂ ਦਾ ਮਕਾਨ ਵਿਕ ਗਿਆ ਅਤੇ ਬਹੁਤ ਉਹ ਵੀ ਬੇਚਾਰੇ ਗਰੀਬ ਸੀਗੇ ਜਿਸ ਕਰਕੇ ਇੰਨੀ ਜਲਦੀ ਛੱਡਣਾ ਔਖਾ ਸੀ ਸਾਡੇ ਪਿੰਡ ਇੱਕ ਬੰਦਾ ਹੈ ਜੀ ਉਹ ਐੱਸ ਜੀ ਪੀ ਸੀ ਦੇ ਵਿਚ ਆ ਜਿਸ ਕਰਕੇ ਉਹਨੂੰ ਪਤਾ ਲੱਗਿਆ ਉਹਨੂੰ ਦੱਸਿਆ ਲੋਕਾਂ ਨੇ ਅਤੇ ਉਹਨੇ ਜੀ ਪੀ ਸੀ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਵੀ ਹਾਂ ਇੱਦਾਂ ਇੱਦਾਂ ਗੱਲ ਆ ਵਿੱਤੀ ਸਹਾਇਤਾ ਬਾਰੇ ਉਹਨਾਂ ਨੇ ਕਿਹਾ ਅਤੇ ਪ੍ਰਧਾਨ ਸਾਹਿਬ ਨੇ ਕਿਹਾ ਕੀ ਕੋਈ ਨਹੀਂ ਅਸੀਂ ਜਿੰਨਾ ਹੋ ਸਕਿਆ ਉਨਾ ਕਰਾਂਗੇ ਇਹ ਸਾਡੇ ਪਿੰਡ ਦਾ ਵਾਕਿਆ ਜਿਸ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਅਤੇ ਉਹਨਾਂ ਨੂੰ ਅਤੇ ਅੱਜ ਉਹਨਾਂ ਦੇ ਘਰ ਉਹਨਾਂ ਨੇ ਪੈਸੇ ਦਿੱਤੇ ਜੋ ਕਿ ਹੁਣ ਉਹਨਾਂ ਦੇ ਘਰ ਠੀਕ ਠਾਕ ਹੈ